ਅੱਜ ਖੇਤੀਬਾੜੀ ਵਿੱਚ ਬਹੁਤ ਸਾਰੀ ਨਵੀਂ ਤਕਨੀਕਾਂ ਆ ਚੁੱਕੀਆਂ ਹਨ ਪਹਿਲਾਂ ਨਾਲੋਂ ਹੁਣ ਖੇਤੀ ਪੱਧਰ ਵਿੱਚ ਬਹੁਤ ਜ਼ਿਆਦਾ ਤਬਦੀਲੀ ਹੋਈ ਹੈ ਪਹਿਲਾਂ ਲੋਕ ਬੱਲ਼ਦਾਂ ਬ ਬੱਲ਼ਦਾਂ ਨਾਲ ਹੀ ਖੇਤ ਵਹਾਉਂਦੇ ਸਨ ਪਰ ਅੱਜ ਦੇ ਜ਼ਮਾਨੇ ਵਿੱਚ ਟਰੈਕਟਰ ਬਹੁਤ ਹੀ ਜ਼ਿਆਦਾ ਲੋੜ ਮ ਮਦਦਗਾਰ ਸਾਬਤ ਹੋਏਆ ਇਹਨਾਂ ਟਰੈਕਟਰਾਂ ਨਾਲ ਘੰਟਿਆਂ ਦਾ ਕੰਮ ਮਿੰਟਾਂ ਵਿੱਚ ਕਰ ਕਰਕ ਕਰ ਸਕਦੇ ਹਨ ਅਸੀਂ ਅਤੇ ਅੱਜ ਦੇ ਜ਼ਮਾਨੇ ਵਿੱਚ ਬਹੁਤ ਸਾਰੀਆਂ ਰੇਹਾਂ ਸਪਰੇਆਂ ਦੀ ਵਰਤੋਂ ਹੋ ਹੋਣ ਲੱਗੀ ਹੈ ਜਿਹਨਾਂ ਨਾਲ ਅਸੀਂ ਆਪਣੀ ਫ਼ਸਲ ਨੂੰ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਬਚਾ ਸਕਦੇ ਹਨ